ਹਾਂਜੀ ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਨਿਰਭਰ ਕਰਦੀ ਹੈ ਬਿਜਲੀ ਦੇ ਬਹੁਤ ਸਾਰੇ ਉਪਕਰਨ ਆ ਚੁੱਕੇ ਹਨ ਜੋ ਸਾਡੀ ਮੁੱਢਲੀ ਲੋੜ ਬਣ ਗਏ ਹਨ ਜਿਵੇਂ ਕਿ ਪੱਖੇ ਬਲਬ ਮਾਈਕ੍ਰੋਵੇਵ ਅਤੇ ਬਹੁਤ ਸਾਰੇ ਉਪਕਰਨ ਇਹਨਾਂ ਸਾਰੇ ਉਪਕਰਨਾਂ ਨੂੰ ਚਲਾਉਣ ਵਾਸਤੇ ਸਾਨੂੰ ਬਿਜ਼ਲੀ ਬਹੁਤ ਜ਼ਰੂਰੀ ਹੈ ਬਿਜਲੀ ਪਹਿਲਾਂ ਤਾਂ ਬਹੁਤ ਸਮੇਂ ਤੋਂ ਬਣ ਰਹੀ ਸੀ ਕੋਲੇ ਨਾਲ ਪਰ ਅੱਜ ਕੱਲ੍ਹ ਨਵੇਂ ਨਵੇਂ ਬਹੁਤ ਸਾਰੇ ਆ ਗਏ ਹਨ ਜਿਵੇਂ ਸੋਲਰ ਪੈਨਲਸ ਹੋ ਗਏ ਟਰਬਾਈਨਜ਼ ਹੋ ਗਈਆਂ ਵਿੰਡ ਮਿਲਜ਼ ਹੋ ਗਈਆਂ ਜਿਹਨਾਂ ਤੋਂ ਬਿਜਲੀ ਤਿਆਰ ਕਰ ਸਕਦੇ ਹਾਂ ਬਿਜਲੀ ਦੇ ਉੱਤੇ ਬਹੁਤ ਸਾਰੇ ਕਰਮਚਾਰੀਆਂ ਨੂੰ ਕੰਮ ਵੀ ਮਿਲਦਾ ਹੈ ਜਿਹਨਾਂ ਦਾ ਘਰ ਉਸ ਤੋਂ ਚੱਲਦਾ ਹੈ ਅਤੇ ਰੋਸ਼ਨੀ ਜਿਵੇਂ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ ਉਹ ਵੀ ਸਾਨੂੰ ਬਿਜਲੀ ਤੋਂ ਹੀ ਮਿਲਦੀ ਹੈ ਜਦੋਂ ਬਿਜਲੀ ਦੇ ਕੱਟ ਲੱਗਦੇ ਹਨ ਤਾਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿਉਂਕਿ ਬਿਜਲੀ ਦਾ ਕੱਟ ਲੱਗਣ ਕਰਕੇ ਏ ਸੀ ਪੱਖੇ ਬਲਬ ਇਹ ਸਾਰੀਆਂ ਚੀਜ਼ਾਂ ਬੰਦ ਹੋ ਜਾਂਦੀਆਂ ਹਨ ਜਿਹਨਾਂ ਦੇ ਬੰਦ ਹੋਣ ਕਾਰਨ ਸਾਡੇ ਕਮਰਿਆਂ ਦੇ ਵਿੱਚ ਜਾਂ ਅੰਦਰਾਂ ਦੇ ਵਿੱਚ ਹਨੇਰਾ ਹੀ ਹਨੇਰਾ ਹੋ ਜਾਂਦਾ ਹੈ ਜਿਹਦੇ ਕਰਕੇ ਸਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ ਪਹਿਲਾਂ ਤਾਂ ਅਕਸਰ ਹੀ ਪਿੰਡਾਂ ਵਿੱਚ ਹੁੰਦਾ ਸੀ ਕਿ ਜਦੋਂ ਬਿਜਲੀ ਦਾ ਕੱਟ ਲੱਗਦਾ ਸੀ ਤਾਂ ਲੋਕਾਂ ਦੇ ਘਰਾਂ ਵਿੱਚ ਲਾਲਟੈਨਾਂ ਹੁੰਦੀਆਂ ਸੀ ਜਿਹਨਾਂ ਨੂੰ ਆਪਾਂ ਜਗਾ ਲੈਂਦੇ ਸੀਗੇ ਪਰ ਅੱਜ ਕੱਲ੍ਹ ਲਾਲਟੈਨਾਂ ਬਹੁਤ ਘੱਟ ਗਈਆਂ ਹਨ ਜਾਂ ਕਈ ਲੋਕ ਮੋਮਬੱਤੀਆਂ ਦਾ ਇੰਤ ਇੰਤਜ਼ਾਮ ਕਰਕੇ ਰੱਖਦੇ ਸੀ ਘਰਾਂ ਵਿੱਚ ਜਦੋਂ ਬਿਜਲੀ ਜਾਣੀ ਕਰਨੀ ਤਾਂ ਮੋਮਬੱਤੀ ਬਾਲ ਲੈਣੀ ਕਰਨੀ ਇਹ ਚੀਜ਼ਾਂ ਸਮੇਂ ਦੇ ਨਾਲ ਜਿਵੇਂ ਜਿਵੇਂ ਘੱਟ ਦੀਆਂ ਜਾ ਰਹੀਆਂ ਹਨ ਤਾਂ ਇਸ ਚੀਜ਼ਾਂ ਦੇ ਉੱਪਰ ਇੱਕ ਇਨਵਰਟਰ ਸਾਡੇ ਕੋਲ ਆ ਗਿਆ ਇਨਵਰਟਰ ਜੋ ਕਿ ਬਿਜਲੀ ਨੂੰ ਸਟੋਰ ਕਰਕੇ ਬੈਟਰਿਆਂ ਵਿੱਚ ਰੱਖਦਾ ਸੀ ਅਤੇ ਜਦੋਂ ਬਿਜਲੀ ਦਾ ਕੱਟ ਲੱਗਦਾ ਹੈ ਤਾਂ ਇਨਵਰਟਰ ਕੀ ਕਰਦਾ ਉਹ ਸਟੋਰ ਬਿਜਲੀ ਨੂੰ ਵਰਤੋਂ ਵਿੱਚ ਲੈ ਕੇ ਆ ਸਕਦਾ ਅਤੇ ਇਹ ਇਨਵਰਟਰ ਸਾਡੇ ਕੋਲ ਵੀ ਹੈ ਸਾਡੇ ਆਸ ਪਾਸ ਦੇ ਲੋਕਾਂ ਕੋਲ ਵੀ ਅੱਜ ਕੱਲ੍ਹ ਬਹੁਤ ਮਿਲ ਜਾਂਦਾ ਹਨ ਤਾਂ ਕਿ ਇਹ ਬਿਜਲੀ ਦੇ ਕੱਟਾਂ ਤੋਂ ਸਾਨੂੰ ਜੋ ਨੁਕਸਾਨ ਹੁੰਦਾ ਹੈ ਉਹ ਨੁਕਸਾਨ ਦੀ ਭਰਪਾਈ ਇਨਵੇਟਰ ਕਰ ਸਕੇ ਪਹਿਲਾਂ ਲੋਕ ਚੁੱਲ੍ਹੇ ਬਾਲਦੇ ਸੀਗੇ ਹੋਰ ਬਹੁਤ ਸਾਰੇ ਸੀਗੇ ਜਿਹਨਾਂ ਕਰਕੇ ਪ੍ਰਦੂਸ਼ਣ ਬੜਾ ਹੁੰਦਾ ਸੀ ਅਤੇ ਬਿਜਲੀ ਆਉਣ ਕਰਕੇ ਉਹ ਹੀ ਚੁੱਲ੍ਹੇ ਅੱਜ ਕੱਲ੍ਹ ਗੈਸ ਨਾਲ ਇਲੈਕਟਰਿਕ ਗੈਸ ਦੇ ਨਾਲ ਬਦਲ ਗਏ ਜਿਹਨਾਂ ਕਰਕੇ ਪ੍ਰਦੂਸ਼ਣ ਵੀ ਘੱਟ ਗਿਆ ਅਤੇ ਕੋਲੇ ਨਾਲ ਬਿਜਲੀ ਜਦੋਂ ਪਹਿਲਾਂ ਬਣਦੀ ਸੀ ਉਹਦੇ ਨਾਲ ਵੀ ਪ੍ਰਦੂਸ਼ਣ ਹੁੰਦਾ ਸੀ ਉਹਦੀ ਥਾਂ 'ਤੇ ਅੱਜ ਕੱਲ੍ਹ ਸੋਲਰ ਪੈਨਲ ਜਾਂ ਡੈਮ ਬਣ ਗਏ ਉਹਨਾਂ ਤੋਂ ਬਿਜਲੀ ਬਣਨ ਲੱਗ ਪਈ ਅਤੇ ਉਹ ਚੀਜ਼ ਦਾ ਵੀ ਸਾਡੇ 'ਤੇ ਬਹੁਤ ਪ੍ਰਭਾਵ ਪਿਆ ਧੰਨਵਾਦ